ਮੈਨੂੰ ਅੱਜ ਵੀ ਯਾਦ ਨੇ ਕਿ ਮੈਂ ਆਪਣੀ ਮਾਤਾ ਪਿਤਾ ਨਾਲ ਮਨਾਲੀ ਵਿਖੇ ਘੁੰਮਣ ਗਈ ਸਾਂ ਉੱਥੇ ਮੈਂ ਆਪਣਾ ਚਿੱਤਰਕਾਰੀ ਦਾ ਸਾਰਾ ਸਮਾਨ ਨਾਲ ਲੈ ਕੇ ਗਈ ਸਾਂ ਉੱਥੇ ਸਾਰਾ ਚਿੱਤਰ ਐਡਾ ਸੋਹਣਾ ਸਹੀ ਕਿ ਮੈਂ ਉਹਨੂੰ ਦੇਖ ਕੇ ਆਪਣੇ ਆਪ ਨੂੰ ਰੋਕ ਨਾ ਪਾਈ ਉੱਥੇ ਮੈਂ ਦੇਖਿਆ ਕਿ ਬਰਫ਼ ਪਹਾੜ ਅਤੇ ਪੰਛੀਆਂ ਨਾਲ ਉਹ ਸਾਰਾ ਵਿਊ ਇੰਨਾ ਸੋਹਣਾ ਸੀ ਕਿ ਮੈਂ ਉਸ ਨੂੰ ਇੱਕ ਚਿੱਤਰ ਵਿੱਚ ਬਣਾਉਣ ਲਈ ਆਪਣੇ ਆਪ ਨੂੰ ਰੋਕ ਨਾ ਪਾਈ ਮੈਂ ਉੱਥੇ ਦੇਖਿਆ ਜਿੱਥੇ ਮੇਰੇ ਮਾਤਾ ਪਿਤਾ ਬੈਠੇ ਸਨ ਉਹਨਾਂ ਦੇ ਪਿੱਛੇ ਪਹਾੜ ਕੁਝ ਦੁਕਾਨਾਂ ਬਰਫ਼ ਅਤੇ ਬਹੁਤ ਸਾਰੇ ਪੰਛੀ ਝਿਲਮਿਲਾ ਰਹੇ ਸਨ ਅਤੇ ਮੈਂ ਉੱਥੇ ਹੀ ਸੋਚਿਆ ਕਿ ਮੈਂ ਆਪਣੇ ਆਪ ਨੂੰ ਕਿੱਦਾਂ ਬਿਆਨ ਕਰਾਂ ਕਿਵੇਂ